ਹੈਲੋ ਹਾਂਜੀ ਨਮਸਤੇ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹਾਂਜੀ ਕੋਵਿਡ ਦੇ ਦੌਰਾਨ ਜੋ ਵੀ ਸਮੱਸਿਆਵਾਂ ਸਾਨੂੰ ਹੁੰਦੀਆਂ ਸਨ ਉਹਨਾਂ ਬਾਰੇ ਮੈਂ ਦੱਸ ਦਿੰਦੀ ਹਾਂ ਹਾਂਜੀ ਜਦੋਂ ਵੀ ਕੋਵਿਡ ਸੀ ਤਾਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਸਨ ਕਿ ਅਸੀਂ ਬਾਹਰ ਵੀ ਨਹੀਂ ਜਾ ਸਕਦੇ ਸਨ ਜਦੋਂ ਵੀ ਅਸੀਂ ਬਾਹਰ ਜਾਂਦੇ ਸੀ ਤਾਂ ਆਪਣੀ ਸੇਫਟੀ ਦਾ ਪੂਰਾ ਧਿਆਨ ਰੱਖਦੇ ਸੀ ਮਾਸਕ ਵਗੈਰਾ ਔਰ ਸੈਨਟਾਈਜ਼ਰ ਵਗੈਰਾ ਆਪਣੇ ਨਾਲ ਕੈਰੀ ਕਰਦੇ ਸੀ ਹਾਂਜੀ ਦੇ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਹਰ ਦੁਕਾਨ ਬੰਦ ਅਤੇ ਹਰ ਬੱਚਿਆਂ ਦੇ ਸਕੂਲ ਵੀ ਬੰਦ ਕੀਤੇ ਗਏ ਸੀ ਅਤੇ ਬਾਹਰ ਜਾਣ ਦੀ ਵੀ ਹਰ ਤਰ੍ਹਾਂ ਦੀ ਹੀ ਪਾਬੰਦੀ ਸੀ ਜਦੋਂ ਕਿ ਕੋਈ ਸਮਾਨ ਵਗੈਰਾ ਲੈਣ ਜਾਣ ਦੀ ਵੀ ਬੜੀ ਮੁਸ਼ਕਿਲ ਸੀ ਜਦੋਂ ਕਿ ਕੋਵਿਡ ਹੋਣ ਕਾਰਨ ਲੋਕਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹਰ ਇਨਸਾਨ ਨੂੰ ਆਪਣੀ ਆਪਣੀ ਜਗ੍ਹਾ ਹੀ ਰਹਿਣਾ ਲਾਜ਼ਮੀ ਜ਼ਰੂਰੀ ਹੋ ਗਿਆ ਸੀ ਜਦੋਂ ਕਿ ਕੋਵਿਡ ਕਾਰਨ ਹਰ ਚੀਜ਼ ਦਾ ਹੀ ਧਿਆਨ ਰੱਖਿਆ ਗਿਆ ਕਿ ਜਦੋਂ ਅਸੀਂ ਬਾਹਰ ਜਾਂਦੇ ਸੀ ਤਾਂ ਜਦੋਂ ਅਸੀਂ ਬਾਹਰ ਜਾਣਾ ਜ਼ਰੂਰੀ ਸਮਝਦੇ ਸੀ ਤਾਂ ਹੀ ਜਾਂਦੇ ਸੀ ਅਤੇ ਘਰ ਆ ਕੇ ਆਪਣੇ ਹੱਥ ਪੈਰ ਸੈਨਟਾਈਜ਼ਰ ਨਾਲ ਧੋ ਕੇ ਅਤੇ ਕਿ ਪੂਰੇ ਕੱਪੜਿਆਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਇਸ਼ਨਾਨ ਕਰਕੇ ਹੀ ਆਪਣੇ ਪਰਿਵਾਰ ਵਿੱਚ ਸ਼ਾਮਿਲ ਹੁੰਦੇ ਸਨ ਅਤੇ ਕੋਵਿਡ ਕੋਲ ਆਪਣੇ ਆਪ ਨੂੰ ਅਸੀਂ ਬਹੁਤ ਮੁਸ਼ਕਿਲਾਂ ਦੇ ਨਾਲ ਬਚਾਇਆ ਸੀ ਅਤੇ ਇਹ ਧੰਨਵਾਦ